ਸਕ੍ਰੈਚ ਤੋਂ ਮੈਂ ਬਹੁਤ ਸਾਰੇ ਅਲੱਗ ਅਲੱਗ ਪਕਵਾਨ ਬਣਾ ਲੈਂਦੀ ਹਾਂ ਅਤੇ ਉਹਨਾਂ ਦਾ ਸਵਾਦ ਵੀ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਇੱਕ ਦਿਨ ਮੈਂ ਟੀ ਵੀ 'ਤੇ ਸ਼ੈੱਫ ਸੰਜੀਵ ਕਪੂਰ ਨੂੰ ਸਕੈਚ ਤੋਂ ਪਕਵਾਨ ਬਣਾਉਂਦੇ ਦੇਖਿਆ ਸੀ ਔਰ ਉਨ ਉਹੀ ਵੇਖ ਕੇ ਮੈਂ ਘਰ ਵਿੱਚ ਟ੍ਰਾਈ ਕੀਤਾ ਔਰ ਸਾਰਿਆਂ ਨੇ ਪਸੰਦ ਵੀ ਬਹੁਤ ਕੀਤਾ ਇਹਦਾ ਸਵਾਦ ਬਹੁਤ ਜ਼ਿਆਦਾ ਵਧੀਆ ਸੀ ਇਹ ਪ੍ਰੇਰਨਾ ਮੈਨੂੰ ਸੰਜੀਵ ਕਪੂਰ ਸਰ ਤੋਂ ਮਿਲੀ